ਬਾਹੂਬਲੀ ਵਨ ਔਰ ਬਾਹੂਬਲੀ ਟੂ ਕੇ ਜੀ ਐਫ਼ ਵਨ ਔਰ ਕੇ ਜੀ ਆਫ਼ ਟੂ ਜਿਵੇਂ ਬਾਹੂਬਲੀ ਮੂਵੀਜ ਵਿੱਚ ਉਹਨਾਂ ਦੇ ਕੱਪੜਿਆਂ ਨੂੰ ਵੱਖਰੇ ਤੌਰ 'ਤੇ ਦਰਸਾਇਆ ਗਿਆ ਹੈ ਅਤੇ ਰਾਣੀਆਂ ਦੇ ਕੱਪੜਿਆਂ ਨੂੰ ਵੀ ਵੱਖਰੇ ਤੌਰ 'ਤੇ ਦਰਸਾਇਆ ਗਿਆ ਹੈ ਉਹਨਾਂ ਦੇ ਕੱਪੜੇ ਦੇਖ ਕੇ ਲੋਕ ਆਪਣੇ ਆਪ ਆਕਰਸ਼ਿਤ ਹੋ ਜਾਂਦੇ ਹਨ ਉਹਨਾਂ ਨੂੰ ਇੱਕ ਅਲੱਗ ਡਰੈਸ ਵਜੋਂ ਜਾਣਿਆ ਜਾਂਦਾ ਹੈ ਅਤੇ ਹਰੇਕ ਉਹਨਾਂ ਦੀ ਜੋ ਵੀ ਮੰਨ ਲਓ ਬੋਡੀ 'ਤੇ ਸਿਰ ਕਵਚ ਬਾਂਹਵਾਂ 'ਤੇ ਪੈਰਾਂ 'ਤੇ ਹਰੇਕ ਤਰ੍ਹਾਂ ਦੀ ਪੂਰੀ ਪ੍ਰੋਟੈਕਸ਼ਨ ਕਵਰ ਕੀਤਾ ਹੁੰਦਾ ਤਾਂ ਜੋ ਉਹਨਾਂ ਨੂੰ ਕਿਸੇ ਵੀ ਮੰਨ ਲਓ ਸੀਨ ਜਾਂ ਇੰਸੀਡੈਂਟ ਕਰਨ ਸਮੇਂ ਕੋਈ ਨੁਕਸਾਨ ਨਾ ਹੋ ਸਕੇ